ਜਗ੍ਹਾ ਜਗ੍ਹਾ ਰੋਜ਼ ਜਗਰਾਤੇ ਹੁੰਦੇ ਹਨ ਮਾਤਾ ਦੀਆਂ ਚੌਕੀਆਂ ਲੱਗਦੀਆਂ ਹਨ ਨੈਣਾਂ ਦੇਵੀ ਦੁਰਗਾ ਦੀ ਪੂਜਾ ਕੀਤ ਵੀ ਲੋਕ ਕਰਦੇ ਹਨ ਅਤੇ ਉੱਧਰ ਜਿਹੜੇ ਗੁਰਪੁਰਬ ਮਨਾਓ ਬੜੇ ਕੀਰਤਨੀਏ ਜਥੇ ਬਣੇ ਹੋਏ ਹਨ ਰਾਗੀ ਢਾਡੀ ਜਾਣੇ ਜਾਂਦੇ ਹਨ ਲੋਕਾਂ ਨੂੰ ਰੁਝਾਉਂਦੇ ਹਨ ਅੱਗੇ ਪਹੁੰਚਾਉਂਦੇ ਹਨ